ਪੁਰਾਣੇ ਸਮੇਂ ਵਿੱਚ ਪਹਿਲਾਂ ਲੋਕ ਵਹੀਕਲਾਂ ਦਾ ਘੱਟ ਹੀ ਇਸਤੇਮਾਲ ਕਰਦੇ ਸਨ ਪਰ ਅੱਜ ਦੇ ਸਮੇਂ ਵਿੱਚ ਕਈ ਪ੍ਰਾਈਵੇਟ ਵਹੀਕਲ ਚੱਲ ਪਏ ਹਨ ਜੋ ਕਿ ਪੈਟਰੋਲ ਉੱਤੇ ਚੱਲਦੇ ਹਨ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਇਹ ਵਹੀਕਲ ਨੂੰ ਚਲਾਉਣ ਵਿੱਚ ਵੀ ਕਈ ਲੋਕਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਇਨਸਾਨ ਇਹ ਵੱਧਦੀ ਪੈਟਰੋਲ ਦੀ ਕੀਮਤ ਦੇ ਕਾਰਨ ਆਪਣੇ ਬਾਈਕ ਵਿੱਚ ਪੈਟਰੋਲ ਪਵਾਉਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਹਰ ਸਾਲ ਪੈਟਰੋਲ ਵਿੱਚ ਵੱਧਦੀ ਕੀਮਤ ਨੂੰ ਦੇਖ ਕੇ ਆਮ ਇਨਸਾਨ ਇੰਨਾ ਮਹਿੰਗਾ ਪੈਟਰੋਲ ਅਫੋਰਡ ਨਹੀਂ ਕਰ ਪਾਉਂਦਾ ਹੈ ਜਿਸ ਕਾਰਨ ਉਹ ਆਪਣੀ ਬਾਈਕ ਵਿੱਚ ਘੱਟ ਹੀ ਪੈਟਰੋਲ ਪਵਾਉਂਦਾ ਹੈ ਅਤੇ ਹਰ ਸਾਲ ਸਰਕਾਰ ਇਹ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੰਦੀ ਹੈ ਇੱਕ ਜਾਂ ਦੋ ਰੁਪਏ ਹਰ ਸਾਲ ਵਾਧਾ ਹੋ ਜਾਂਦਾ ਹੈ ਜਿਸ ਕਾਰਨ ਆਮ ਇਨਸਾਨ ਇਹ ਪੈਟਰੋਲ ਦੀ ਕੀਮਤਾਂ ਨੂੰ ਚੱਕ ਨਹੀਂ ਪਾਉਂਦਾ ਹੈ ਅੱਜ ਕੱਲ੍ਹ ਬਾਲਣ ਦੀ ਵੀ ਜ਼ਿਆਦਾ ਵਰਤੋਂ ਹੋਣ ਲੱਗ ਪਈ ਹੈ ਬਾਲਣ ਨਾਲ ਕਈ ਸਾਰੀਆਂ ਗੈਸਾਂ ਪ੍ਰਭਾਵਿਤ ਹੁੰਦੀਆਂ ਹਨ ਜੋ ਕਿ ਸਾਡੇ ਵਾਤਾਵਰਨ ਲਈ ਚੰਗੀਆਂ ਨਹੀਂ ਹਨ ਸਾਨੂੰ ਬਾਲਣ ਦਾ ਇਸਤੇਮਾਲ ਕਰਨਾ ਬੰਦ ਕਰ ਦੇਣ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਡਾ ਵਾਤਾਵਰਨ ਖ਼ਰਾਬ ਹੋ ਰਿਹਾ ਹੈ